ਸਤਿ ਸ਼੍ਰੀ ਅਕਾਲ ਸਰ ਜੀ ਹਾਂਜੀ ਮਤਲਬ ਕਿ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਕਿ ਗਰਮੀਆਂ 'ਚ ਔਰ ਸਰਦੀਆਂ ਵਿੱਚ ਮਲਕੀ ਕਿਸੇ ਕਿਸ ਦੀ ਲੋੜ ਹੁੰਦੀ ਹੈ ਗਰਮੀਆਂ ਵਿੱਚ ਗਰਮੀਆਂ ਵਾਲੀ ਸਬਜ਼ੀ ਲੱਗਦੀ ਆ ਫ਼ਸਲ ਹੁੰਦੀ ਹੈ ਅਤੇ ਸਰਦੀਆਂ ਵਿੱਚ ਸਰਦੀਆਂ ਦੀ ਫ਼ਸਲ ਹੁੰਦੀ ਆ ਔਰ ਗਰਮੀ ਵਿੱਚ ਮਲਕੀ ਜਿੱਦਾਂ ਗਰਮੀ ਵਿੱਚ ਸਬਜ਼ੀਆਂ ਆਉਂਦੀਆਂ ਕਰੇਲੇ ਹੋ ਗਏ ਬੈਂਗਣ ਹੋ ਗਏ ਟਿੰਡੇ ਹੋ ਗਏ ਸਾਰੀਆਂ ਚੀਜ਼ਾਂ ਲੱਗਦੀਆਂ ਫ਼ਸਲ ਵਿੱਚ ਅਤੇ ਗਰਮੀਆਂ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਲੱਗਦੀਆਂ ਆ ਅਤੇ ਹੁਣ ਮਲਕੀ ਸਰਦੀ ਵਿੱਚ ਕਣਕ ਲੱਗਦੀ ਹੈ ਉਹ ਮਤਲਬ ਕਿ ਖ਼ਤਮ ਹੋ ਗਈ ਆ ਅਤੇ ਹੁਣ ਗਰਮੀਆਂ ਵਿੱਚ ਗਰਮੀਆਂ ਵਿੱਚ ਹੁਣ ਮਲਕੀ ਝੋਨੇ ਦਾ ਸੀਜ਼ਨ ਆ ਗਿਆ ਆ ਝੋਨਾ ਲੱਗਦਾ ਆ ਫ਼ਸਲ ਅਤੇ ਮਲਕੀ ਉਹ ਲਾ ਕੇ ਮਲਕੀ ਕੋਈ ਵੀ ਚੀਜ਼ ਹੈ ਜਿਹੜੀ ਗਰਮੀਆਂ ਵਿੱਚ ਜਿਹੜੀ ਲੱਗਦੀ ਆ ਉਹ ਗਰਮੀਆਂ ਵਿੱਚ ਹੀ ਲਗਾਉਣੀ ਪੈਂਦੀ ਆ ਅਤੇ ਅਸੀਂ ਸਬਜ਼ੀਆਂ ਦੀ ਦੇਖਭਾਲ ਅਸੀਂ ਗਰਮੀਆਂ ਵਿੱਚ ਇਸ ਤਰ੍ਹਾਂ ਕਰਦੇ ਹਾਂ ਦੋ ਟਾਈਮ ਪਾਣੀ ਦੇ ਕੇ ਸਵੇਰੇ ਪਾਣੀ ਦੇਣਾ ਅਤੇ ਸ਼ਾਮੀ ਪਾਣੀ ਦੇਣਾ ਮਲਕੀ ਉਹਨੂੰ ਕੀੜੇ ਮਕੌੜੇ ਤੋਂ ਵੀ ਬਚਾਉਣਾ ਅਸੀਂ ਕੀ ਮਲਕੀ ਕੋਈ ਕੀੜਾ ਮਕੌੜਾ ਮਲਕੀ ਉਹਦੀ ਪੱਤੇ ਨਾ ਖਾ ਸਕਣ ਦਵਾਈਆਂ ਦਵੁਈਆਂ ਛੜਕਾਉਣੀਆਂ ਪੈਂਦੀਆਂ ਆ ਉਹਦੀ ਦੇਖਭਾਲ ਅਸੀਂ ਇਸ ਤਰ੍ਹਾਂ ਕਰਦੇ ਹਾਂ ਜਿਸ ਤਰ੍ਹਾਂ ਮਲਕੀ ਬੱਚਿਆਂ ਦੀ ਦੇਖਭਾਲ ਕਰਦੇ ਹਾਂ ਛੋਟੇ ਬੂਟਿਆਂ ਦੀ ਫ਼ਸਲ ਜਿਸ ਦੇ ਲਗਾਉਂਦੇ ਹਾਂ ਸਾਨੂੰ ਉਹਦੀ ਬਹੁਤ ਦੇਖਭਾਲ ਕਰਨੀ ਪੈਂਦੀ ਹੈ ਅਤੇ ਅਸੀਂ ਮਲਕੀ ਉਹਦੇ ਮਲਕੀ ਸੁਆਹ ਵੀ ਮਲਕੀ ਸੁੱਟਦੇ ਹਾਂ ਪੱਤਿਆਂ 'ਤੇ ਕੀ ਕੀੜਾ ਨਾ ਲੱਗੇ ਅਤੇ ਉਹਨੂੰ ਦੋ ਟਾਈਮ ਪਾਣੀ ਵੀ ਦੇਣੇ ਪੈਂਦਾ ਹੈ ਸਵੇਰੇ ਸ਼ਾਮੀ ਕੀ ਫ਼ਸਲ ਸਾਡੀ ਮਲਕੀ ਸਬਜ਼ੀਆਂ ਠੀਕ ਠਾਕ ਰਹਿਣ ਅਤੇ ਉਦਾਂ ਹੀ ਬਚਾ ਕਰੀਏ ਠੀਕ